ਮੈਂ ਜਦੋਂ ਵੀ ਆਪਣਾ ਜਾਂ ਮੋਰ ਕਿਸੇ ਮੋਡਲ ਦਾ ਚਿੱਤਰ ਬਣਾਉਣਾ ਸ਼ੁਰੂ ਕਰਦੀ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰਦੀ ਹਾਂ ਕਿ ਮੈਂ ਮੋਡਲ ਨੂੰ ਚੰਗੀ ਤਰ੍ਹਾਂ ਅਧਿਐਨ ਕਰ ਲਵਾਂ ਮੈਂ ਉਸਦੇ ਨਿੱਕੇ ਤੋਂ ਨਿੱਕੇ ਆਕਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਮੇਰੀ ਜ਼ਿਆਦਾਤਰ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਮੈਂ ਲਾਈਵ ਸਕੈਚਿੰਗ ਹੀ ਕਰ ਸਕਾਂ ਮੈਂ ਮੋਡਲ ਨੂੰ ਸਾਹਮਣੇ ਬਿਠਾ ਕੇ ਚਿੱਤਰ ਦੀ ਸਭ ਤੋਂ ਸ਼ੁਰੂਆਤ ਵਿੱਚ ਆਸਾਨ ਆਕਾਰਾਂ ਨਾਲ ਕਰਦੀ ਹਾਂ ਇਸ ਤਰ੍ਹਾਂ ਮੈਂ ਸਰੀਰ ਨੂੰ ਬਹੁਤ ਹੀ ਬਿਹਤਰ ਤਰੀਕੇ ਨਾਲ ਸੰਤੁਲਿਤ ਕਰ ਸਕਦੀ ਹਾਂ ਮੈਂ ਚਿੱਤਰ ਨੂੰ ਕੁਦਰਤੀ ਬਣਾਉਣ ਲਈ ਉਹਦੇ ਵਿੱਚ ਲਚਕਦਾਰ ਰੇਖਾਵਾਂ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਉਹ ਕਾਫ਼ੀ ਲਚਕਦਾਰ ਲੱਗਦੇ ਹਨ ਅਤੇ ਉਹ ਕਾਫ਼ੀ ਦੇਖਣ ਨੂੰ ਕੁਦਰਤੀ ਲੱਗਦੇ ਹਨ ਤੀਸਰਾ ਮੈਂ ਆਪਣੀ ਚਿੱਤਰ ਵਿੱਚ ਥਰੀ ਡੀ ਫੋਰਮ ਲਿਆਉਣ ਵਾਸਤੇ ਮੈਂ ਪਰਸਪੈਕਟਿਵ ਦੀ ਵਰਤੋਂ ਕਰਦੀ ਹਾਂ ਜਿਸ ਨਾਲ ਚੀਜ਼ ਬਹੁਤ ਹੀ ਸੋਹਣੀ ਉਭਰ ਕੇ ਆਉਂਦੀ ਹੈ

ਤਾਂ ਅਗਰ ਜੇਕਰ ਮੈਂ ਗੱਲ ਕਰਾਂ ਕੋਈ ਟੂਲ ਜਾਂ ਦਿਸ਼ਾ ਨਿਰਦੇਸ਼ਾਂ ਦੀ ਤਾਂ ਮੈਂ ਆਪਣੇ ਚਿੱਤਰ ਨੂੰ ਚੈੱਕ ਕਰਨ ਵਾਸਤੇ ਮੈਂ ਓਵਰਲੇ ਤਕਨੀਕ ਯੂਜ ਕਰਦੀ ਹਾਂ ਮੈਂ ਪ੍ਰਿੰਟ ਕਰਕੇ ਪੇਪਰ ਨੂੰ ਆਪਣੇ ਬਾਜੋਂ ਚਿੱਤਰ ਉੱਤੇ ਰੱਖ ਕੇ ਦੇਖਦੀ ਹਾਂ ਹਰ ਰੇਖਾਵਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਮੈਂ ਦੇਖ ਸਕਾਂ ਕਿ ਉਹ ਸਹੀ ਬਣੇ ਹਨ ਜਾਂ ਮੈਂ ਚਿੱਤਰ ਨੂੰ ਉਲਟਾ ਕਰਕੇ ਵੇਖਦੀ ਹਾਂ ਕਿਉਂਕਿ ਇਸ ਨਾਲ ਸਾਨੂੰ ਸਾਡੀ ਗਲਤੀਆਂ ਦਾ ਸੌਖੇ ਤਰੀਕੇ ਨਾਲ ਵੇਖਣ ਨਾਲ ਮਦਦ ਕਰੇਗਾ